ਪੰਜਾਬ ਵਿੱਚ ਬਹੁਤ ਹੀ ਮੁੱਖ ਸੱਭਿਆਚਾਰਕ ਅਤੇ ਸਮਾਜਿਕ ਨਿਯਮ ਸੀਗੇ ਜਿਵੇਂ ਪਹਿਲਾਂ ਕਿ ਲੜਕੀਆਂ ਨੂੰ ਪੜ੍ਹਨ ਨਹੀਂ ਸੀਗਾ ਦਿੱਤਾ ਜਾਂਦਾ ਅਤੇ ਜੇ ਜਿਹੜੇ ਲੜਕੇ ਹੁੰਦੇ ਸੀਗੇ ਉਹਨਾਂ ਨੂੰ ਉੱਚਾ ਸਮਝਿਆ ਜਾਂਦਾ ਸੀਗਾ ਲੜਕੀਆਂ ਦੇ ਨਾਲੋਂ ਅਤੇ ਪੁਰਾਣੇ ਵਿਆਹਵਾਂ ਦੇ ਵਿੱਚ ਜਿਵੇਂ ਸੀਗੇ ਕਿ ਜੋ ਸਿਰਫ ਬਰਾਤ ਵਿੱਚ ਜਿਵੇਂ ਔਰਤਾਂ ਜਾਂ ਲੜਕੀਆਂ ਨਹੀਂ ਸੀਗੀਆਂ ਜਾ ਸਕਦੀਆਂ ਉਹਨਾਂ ਨੂੰ ਨਹੀਂ ਸੀ ਜਾਣ ਦਿੱਤਾ ਜਾਂਦਾ ਅਤੇ ਸਿਰਫ ਮਰਦ ਹੀ ਜਾਂ ਫਿਰ ਬੰਦੇ ਹੀ ਜਾਂਦੇ ਸੀਗੇ ਅਤੇ ਜਿਵੇਂ ਕਿਸੇ ਦੀ ਮੌਤ ਦੇ ਉੱਪਰ ਵੀ ਅਗਰ ਦਾਗ ਲਗਾਉਣ ਜਾਂਦੇ ਸੀਗੇ ਉੱਥੇ ਵੀ ਸਿਰਫ਼ ਜਿਹੜੇ ਮਰਦ ਸੀਗੇ ਉਹਨਾਂ ਨੂੰ ਹੀ ਜਾਣ ਦਿੱਤਾ ਜਾਂਦਾ ਸੀਗਾ ਬੰਦਿਆਂ ਨੂੰ ਹੀ ਜਾਣ ਦਿੱਤਾ ਜਾਂਦਾ ਸੀਗਾ ਇਸ ਤੋਂ ਇਲਾਵਾ ਵੀ ਕਾਫੀ ਚੇਂਜਿਸ ਆਏ ਸੀਗੇ ਜਿਵੇਂ ਕਿ ਪਹਿਲਾਂ ਸਮੇਂ ਦੇ ਵਿੱਚ ਜਿਨ ਹਰ ਇੱਕ ਖੇਤਰ ਦੀ ਅਲ ਅਲਗ ਅਲਗ ਭਾਸ਼ਾਵਾਂ ਹੁੰਦੀਆਂ ਸੀਗੀਆਂ ਅਲਗ ਅਲਗ ਉੱਥੋਂ ਦਾ ਪਹਿਨਾਵਾ ਜਾਂ ਖਾਣ ਪੀਣ ਦਾ ਹੁੰਦਾ ਸੀਗਾ ਕਿਉਂਕਿ ਪਹਿਲੇ ਸਮੇਂ ਵਿੱਚ ਆਵਾਜਾਈ ਬਹੁਤ ਹੀ ਘੱਟ ਹੁੰਦੀ ਸੀਗੀ ਜਿਸ ਕਰਕੇ ਉਹਨਾਂ ਦਾ ਜੋ ਭਾਈਚਾਰਾ ਹੈ ਮਤਲਬ ਬੋਲਚਾਲ ਹੁੰਦਾ ਸੀਗਾ ਉਹ ਸਾਰਿਆਂ ਦਾ ਆਪਣਾ ਆਪਣਾ ਵ ਅਲਗ ਹੁੰਦਾ ਸੀਗਾ ਬਟ ਜਿਵੇਂ ਜਿਵੇਂ ਸਮਾਜ ਵਿਕਸਿਤ ਹੋ ਰਿਹਾ ਹੈ ਉਸ ਸਮਾਂ ਆਵਾਜਾਈ ਜੋ ਵਿਕਸਿਤ ਹੋਈ ਆ ਉਸ ਦੇ ਨਾਲ ਹੀ ਜਿਵੇਂ ਲੋਕ ਇੱਕ ਦੂਸਰੇ ਨਾਲ ਮਿਲਦੇ ਹਨ ਦੂਸਰੇ ਖੇਤਰ ਦੇ ਲੋਕਾਂ ਨਾਲ ਮਿਲਦੇ ਹਨ ਉਹਦੇ ਕਰਕੇ ਜੋ ਉੱਥੋਂ ਦੀਆਂ ਭਾਸ਼ਾਵਾਂ ਜੋ ਹੈ ਉਹ ਵੀ ਆਪਸ ਦੇ ਵਿੱਚ ਚੇਂਜ ਹੁੰਦੀਆਂ ਗਈਆਂ ਜਾਂ ਇੱਕ ਦੂਜੇ ਨੂੰ ਪਤਾ ਲੱਗਦੀਆਂ ਗਈਆਂ ਜਿਹੜਾ ਖਾਣਾ ਪੀਣਾ ਸੀ ਜਾਂ ਪਹਿਨਾਵਾ ਸੀਗਾ ਉਹ ਵੀ ਸਾਰੇ ਅਪਣਾਉਣ ਲੱਗ ਗਏ ਦੂਸਰੇ ਖੇਤਰ ਵਾਲੇ ਵੀ ਅਤੇ ਇਸ ਨਾਲ ਕਾਫੀ ਚੇਂਜਿਸ ਆਏ ਹੁਣ ਤੱਕ ਹੁਣ ਤੱਕ ਕਾਫੀ ਚੇਂਜਿਸ ਆ ਚੁੱਕੇ ਗਏ ਨੇ ਬਾਹਰਲੇ ਦੇਸ਼ਾਂ ਦੇ ਵੀ ਕੁਛ ਜੋ ਸੱਭਿਆਚਾਰ ਨੇ ਉਹ ਇਸ ਇੰਡੀਆ ਵਿੱਚ ਅਪਣਾਏ ਗਏ ਹਨ ਥੈਂਕ ਯੂ